ਮੈਂ ਵਾਈਫਾਈ 'ਤੇ ਇੰਟਰਨੈੱਟ ਦੀ ਵਰਤੋਂ ਰੋਜ਼ਾਨਾ ਕਰਦਾ ਹਾਂ ਕਿਉਂਕਿ ਮੈਂ ਬਹੁਤ ਸ਼ੌਕੀ ਬੰਦਾ ਹਾਂ ਅਤੇ ਮੈਨੂੰ ਫਿਲਮ ਦੇਖਣ ਦਾ ਬਹੁਤ ਹੀ ਸ਼ੌਕ ਹੈ ਜਿਸ ਦੇ ਲਈ ਮੈਂ ਵਾਈਫਾਈ ਦੀ ਵਰਤੋਂ ਕਰਦਾ ਹਾਂ ਕਈ ਫਿਲਮਾਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦਾ ਡਾ ਜਿਹਨਾਂ ਨੂੰ ਵੇਖਣ ਲਈ ਡਾਟਾ ਬਹੁਤ ਜ਼ਿਆਦਾ ਕੰਨਜ਼ਿਊਮ ਹੁੰਦਾ ਹੈ ਜੋ ਕਿ ਆਪਾਂ ਮੌਜੂਦਾ ਪਲੈਨ ਰਾਹੀਂ ਨਹੀਂ ਦੇਖ ਸਕਦੇ ਜਿਸ ਲਈ ਮੈਨੂੰ ਵਾਈਫਾਈ ਦੀ ਲੋੜ ਪੈਂਦੀ ਹੈ